ਸਾਡੇ ਖੇਤਰ ਵਿੱਚ ਬਹੁਤ ਬਹੁਤ ਬਹੁਤ ਵੱਖ ਵੱਖ ਤਰ੍ਹਾਂ ਦੇ ਸੱਭਿਆਚਾਰ ਸਮੂਹ ਲੋਕ ਰਹਿੰਦੇ ਹਨ ਜਦੋਂ ਜਿਵੇਂ ਕਿ ਪੰਜਾਬੀ ਲੋਕ ਹੋ ਗਏ ਹਿਮਾਚਲ ਮਰਾਠੀ ਗੁਜਰਾਤੀ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕਰਦੀ ਹਾਂ ਤਾਂ ਮੈਨੂੰ ਉਹਨਾਂ ਦੇ ਸੱਭਿਆਚਾਰ ਬਾਰੇ ਪਤਾ ਚੱਲਦਾ